ਮੈਨੂੰ ਨਹੀਂ ਲੱਗਦਾ ਕਿ ਹੋਰਾਂ ਗ੍ਰਹਿਆਂ 'ਤੇ ਜੀਵਨ ਹੈ ਮੈਨੂੰ ਤਾਂ ਲੱਗਦਾ ਹੈ ਕਿ ਸਿਰਫ਼ ਧਰਤੀ 'ਤੇ ਹੀ ਜੀਵਨ ਹੈ ਜਿਵੇਂ ਕਿ ਅਸੀਂ ਸੁਣਿਆ ਹੈ ਅਤੇ ਕਹਾਣੀਆਂ ਕਿਤਾਬਾਂ ਵਿੱਚ ਪੜ੍ਹਿਆ ਵੀ ਹੈ ਕਿ ਕਈ ਗ੍ਰਹਿਆਂ 'ਤੇ ਜੀਵਨ ਹੈ ਪਰ ਅੱਜ ਤੱਕ ਦੇਖਿਆ ਤਾਂ ਕਿਸੇ ਨੇ ਵੀ ਨਹੀਂ ਹੈ ਕਈ ਫਿਲਮਾਂ ਵਿੱਚ ਵੀ ਅਤੇ ਗ੍ਰਹਿਆਂ 'ਤੇ ਹੋਰ ਦੁਨੀਆਂ ਬਾਰੇ ਦੱਸਿਆ ਗਿਆ ਹੈ ਪਰ ਇਹ ਤਾਂ ਮੈਨੂੰ ਅੱਤ ਕਥਨੀ ਲੱਗਦੀਆਂ ਨੇ ਜਿਵੇਂ ਕਿ ਫਿਲਮਾਂ ਵਿੱਚ ਏਲੀਅਨ ਬਾਰੇ ਦੱਸਿਆ ਗਿਆ ਹੈ ਕਿ ਏਲੀਅਨ ਹੁੰਦੇ ਨੇ ਪਰ ਅੱਜ ਤੱਕ ਦੇਖੇ ਤਾਂ ਕਿਸੇ ਨੇ ਵੀ ਨਹੀਂ ਮੈਨੂੰ ਤਾਂ ਇਹ ਸਭ ਗੱਲਾਂ ਕਾਲਪਨਿਕ ਲੱਗਦੀਆਂ ਹਨ ਏਲੀਅਨ ਨੂੰ ਲੈ ਕੇ ਬਹੁਤ ਫਿਲਮਾਂ ਬਣਾਈਆਂ ਹਨ ਜਿਸ ਵਿੱਚ ਦਿਖਾਇਆ ਜਾਂਦਾ ਹੈ ਕਿ ਹੋਰਾਂ ਗ੍ਰਹਿਆਂ 'ਤੇ ਦੁਨੀਆਂ ਹੈ ਉਹ ਸਾਡੇ ਤੋਂ ਵੱਖਰੇ ਨੇ ਉਹਨਾਂ ਦਾ ਰਹਿਣ ਸਹਿਣ ਵੀ ਸਾਡੇ ਨਾਲ਼ੋਂ ਵੱਖਰਾ ਹੈ ਅਵਤਾਰ ਮੂਵੀ ਵਿੱਚ ਵੀ ਦੂਸਰੀ ਦੁਨੀਆਂ ਦੇ ਜੀਵਾਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਇਹ ਮੂਵੀ ਦੂਸਰੀ ਦੁਨੀਆਂ ਦੇ ਜੀਵਾਂ 'ਤੇ ਅਧਾਰਿਤ ਹੈ ਸਾਇੰਸ ਨੇ ਵੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਕਿ ਦੂਸਰੇ ਗ੍ਰਹਿਆਂ 'ਤੇ ਜੀਵਨ ਹੈ ਵੀ ਕਿ ਨਹੀਂ ਸਾਇੰਸ ਦੀ ਖੋਜ ਅਜੇ ਜਾਰੀ ਹੈ ਚੰਦਰਮਾ 'ਤੇ ਵੀ ਜੀਵਨ ਦੀ ਕੋਈ ਪੁਸ਼ਟੀ ਨਹੀਂ ਹੈ ਅਤੇ ਨਾ ਹੀ ਮੰਗਲ ਗ੍ਰਹਿ 'ਤੇ ਹੋਈ ਹੈ ਸਾਇੰਸ ਦਾ ਕਹਿਣਾ ਹੀ ਸੀ ਕਹਿਣਾ ਹੈ ਕਿ ਪਹਿਲੇ ਕਿਤੇ ਮੰਗਲ ਗ੍ਰਹਿ 'ਤੇ ਜੀਵਨ ਸੀ ਪਰ ਹੁਣ ਨਹੀਂ ਹੈ ਇਸੇ ਤਰ੍ਹਾਂ ਮਾਰਸ 'ਤੇ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮਾਰਸ 'ਤੇ ਪਹਿਲਾਂ ਕਿਤੇ ਜੀਵਨ ਸੀ ਪਰ ਹੁਣ ਨਹੀਂ ਹੈ ਮੈਨੂੰ ਤਾਂ ਲੱਗਦਾ ਹੈ ਦੂਸਰੇ ਗ੍ਰਹਿਆਂ 'ਤੇ ਕੋਈ ਵੀ ਜੀਵਨ ਦੀ ਪੁਸ਼ਟੀ ਨਹੀਂ ਹੋਈ ਹੈ ਮੇਰਾ ਮੰਨਣਾ ਹੈ ਕਿ ਜੀਵਨ ਸਿਰਫ਼ ਧਰਤੀ 'ਤੇ ਹੀ ਹੈ ਹੋਰ ਕਿਸੇ ਗ੍ਰਹਿ 'ਤੇ ਨਹੀਂ ਹੈ ਧੰਨਵਾਦ